ਅੱਜ ਕੱਲ੍ਹ ਜਿਵੇਂ ਪਤਾ ਹੀ ਹੈ ਕਿ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਕਿ ਆਪਾਂ ਨੂੰ ਬਹੁਤ ਸਾਰਾ ਰੁਜ਼ਗਾਰ ਦਿੰਦੀਆਂ ਪਈਆਂ ਨੇ ਅਤੇ ਇਸ ਲਈ ਹੀ ਮੈਂ ਆਪਣਾ ਪਾਸਪੋਟ ਦੀ ਅਵਧੀ ਨੂੰ ਅੱਗੇ ਵਧਾਉਣ ਬਾਰੇ ਸੋਚ ਰਹੀ ਹਾਂ ਕਿ ਜੇ ਮੇਰਾ ਉਹ ਵੱਧਦਾ ਹੈ ਤਾਂ ਮੈਨੂੰ ਬਹੁਤ ਸਾਰੇ ਅਵਸਰ ਮਿਲਦੇ ਨੇ ਜਿਸ ਰਾਹੀਂ ਮੈਂ ਨੂੰ ਅੱਗੇ ਤਰੱਕੀ ਕਰਨ ਦਾ ਮੌਕਾ ਵੀ ਮਿਲਦਾ ਹੈ ਜੇ ਇਸ ਗੱਲੋਂ ਮੈਂ ਕਿਤੇ ਗਲਤ ਵੀ ਹਾਂ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋਂ ਜੇ ਇਸ ਲਈ ਮੈਂ ਤੁਹਾਡੇ ਨਾਲ ਇੱਕ ਵਾਰੀ ਆਪਦੇ ਵਿਚਾਰ ਸਾਂਝੇ ਕਰ ਰਹੀ ਹਾਂ ਕਿ ਜੇ ਕਿਤੇ ਮੈਂ ਗਲਤ ਹੁੰਦੀ ਹਾਂ ਤਾਂ ਵੀ ਤੁਸੀਂ ਮੈਨੂੰ ਦੱਸ ਸਕੋ ਕਿ ਤੁਹਾਡੀ ਵੀ ਰਾਏ ਦੱਸੋ ਕੀ ਮੈਂ ਆਪਣਾ ਪਾਸਪੋਟ ਦੀ ਅਵਧੀ ਅੱਗੇ ਵਧਾਵਾਂ ਜਾਂ ਨਹੀਂ